ਹਾਂਜੀ ਤੁਸੀਂ ਰੀਤਿਕਾ ਮੈਮ ਬੋਲਦੇ ਪਏ ਹੋ ਹਾਂਜੀ ਮੈਮ ਮੈਂ ਯੋਗਾ ਇੰਸਟਰਕਟਰ ਨੂੰ ਕੋਲ ਲਗਾਈ ਸੀ ਅਤੇ ਮੈਂ ਯੋਗਾ ਬਾਰੇ ਜਾਣਨਾ ਚਾਹੁੰਦੀ ਸੀ ਮੈਂ ਐਕਚੁਲੀ ਯੋਗਾ ਕਲਾਸਿਸ ਜੁਆਇਨ ਕਰਨਾ ਚਾਹੁੰਦੀ ਹਾਂ ਤੁਸੀਂ ਪਲੀਜ਼ ਥੋੜ੍ਹਾ ਡਿਟੇਲ 'ਚ ਮੈਨੂੰ ਸਮਝਾ ਸਕਦੇ ਹੋ ਹਾਂਜੀ ਮੈਮ ਹਾਂਜੀ ਮੈਮ ਮੈਂ ਸਟੂਡੈਂਟ ਹਾਂ ਮੈਂ ਐਕਚੁਲੀ ਹੁਣੇ ਰੀਸੈਂਟਲੀ ਪਲੱਸ ਟੂ ਕੰਪਲੀਟ ਕੀਤੀ ਹੈ ਅਤੇ ਮੈਂ ਘਰ ਹੁਣ ਥੋੜ੍ਹੇ ਦਿਨਾਂ ਤੋਂ ਘਰ ਰਹਿ ਰਹੀ ਹਾਂ ਉਹਦੇ ਕਰਕੇ ਮੈਨੂੰ ਲੱਗ ਰਿਹਾ ਕਿ ਥੋੜ੍ਹਾ ਮੇਰੇ ਬੋਡੀ ਥੋੜ੍ਹੀ ਹੈ ਅਨਫਿੱਟ ਜਿਹੀ ਹੋ ਗਈ ਹੈ ਇਸ ਕਰਕੇ ਮੈਂ ਚਾਹੁੰਦੀ ਐਂ ਕਿ ਚਲੋ ਯੋਗਾ ਦੀ ਕਲਾਸ ਜੁਆਇਨ ਕਰਕੇ ਥੋੜ੍ਹਾ ਆਪਣੇ ਆਪ ਨੂੰ ਇੱਕ ਤਾਂ ਥੋੜ੍ਹਾ ਬਿਜੀ ਰੱਖ ਸਕੀਏ ਦੂਸਰਾ ਥੋੜ੍ਹੀ ਬੋਡੀ ਫਿੱਟ ਰੱਖ ਸਕੀਏ ਇਸ ਕਰਕੇ ਪਲੀਜ ਟਾਈਮਿੰਗ ਹਾਂਜੀ ਮੈਮ ਲੋਕੇਸ਼ਨ ਆਪਣੀ ਮੈਨੂੰ ਦੱਸ ਸਕਦੇ ਹੋ ਤੁਸੀਂ ਜੀ ਮੈਮ ਹਾਂਜੀ ਠੀਕ ਹੈ ਮੈਮ ਥੈਂਕ ਯੂ ਸੋ ਮਚ ਮੈਮ ਹਾਂਜੀ ਮੈਂ ਕ ਕੋਸ਼ਿਸ਼ ਕਰਾਂਗੀ ਮੈਮ ਮੈਂ ਕੱਲ੍ਹ ਵਿਜਿਟ ਕਰਕੇ ਅਤੇ ਮੈਂ ਸਾਰਾ ਕੁਛ ਤੁਹਾਡੇ ਕੋਲੋਂ ਉੱਥੇ ਸਮਝ ਲਵਾਂਗੀ ਆ ਕੇ ਅਤੇ ਮੈਮ ਮੈਂ ਕੋਸ਼ਿਸ਼ ਕਰਾਂਗੀ ਸਵੇਰੇ ਅਰਲੀ ਮੋਰਨਿੰਗ ਮੈਂ ਦਸ ਵਜੇ ਤੁਹਾਡੇ ਉੱਥੇ ਵਿਜਿਟ ਕਰ ਲਵਾਂਗੀ

ਧੰਨਵਾਦ ਮੈਮ